ਉਹ ਕਿਤਾਬ ਜਿਹੜੀ ਮੈਨੂੰ ਸੋਚਣ ਲਈ ਮਜ਼ਬੂਰ ਕਰੇ ਉਹ ਹੈ ਪਿੰਜਰ ਪਿੰਜਰ ਮੈਂ ਰੀਸੈਂਟਲੀ ਪੜ੍ਹਿਆ ਸੀ ਪਿੰਜਰ ਅੰਮ੍ਰਿਤਾ ਪ੍ਰੀਤਮ ਦਾ ਨਾਵਲ ਹੈ ਇਸ ਨਾਵਲ ਵਿੱਚ ਜਿਹੜਾ ਹੈ ਲੇਡੀਜ਼ ਦੀ ਕੰਡੀਸ਼ਨ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਮਾਜ ਲੇਡੀਜ਼ ਨੂੰ ਪੁਸ਼ ਕਰਦਾ ਪਰੇਸ਼ਾਨ ਕਰਦਾ ਕਿਸੇ ਵੀ ਹਾਲਾਤ ਵਿੱਚ ਨਹੀਂ ਜੀਣ ਦਿੰਦਾ ਕਈ ਵਾਰ ਤੁਹਾਡੀ ਫੈਮਲੀਸ ਦੀਆਂ ਦੁਸ਼ਮਣੀਆਂ ਜਿਹੜੀਆਂ ਨੇ ਜਾਂ ਫਿਰ ਕੁਝ ਉਹ ਸਿਰਫ ਇੱਕ ਮੇਨ ਤੌਰ 'ਤੇ ਲੇਡੀਜ਼ ਨੂੰ ਹੀ ਉਹਦੀ ਕਮਜ਼ੋਰੀ ਸਮਝ ਕੇ ਖਾਨਦਾਨ ਦੀ ਉਸ ਨੂੰ ਜਿਹੜਾ ਹੈਗਾ ਉਸ 'ਤੇ ਵਾਰ ਕੀਤਾ ਜਾਂਦਾ ਹੈ ਉਸ ਨਾਲ ਜਬਰਦਸਤੀ ਕੀਤੀ ਜਾਂਦੀ ਹੈ ਸੋ ਮੈਨੂੰ ਮੋਸਟਲੀ ਇਸ ਚੀਜ਼ ਬਾਰੇ ਸਿਰਫ ਇੰਨਾ ਹੀ ਪਤਾ ਇਹ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਸੀ ਇਹ ਨਾਵਲ ਤੋਂ ਅਤੇ ਇਹਨੇ ਮੈਨੂੰ ਸੱਚੀ ਇਹ ਸੋਚਣ ਲਈ ਮਜ਼ਬੂਰ ਕਰਤਾ ਕਿ ਸਮਾਜ ਜਿਹੜਾ ਹੈ ਕਿਸ ਤਰੀਕੇ ਦਾ ਹੈ ਕਿਉਂ ਇਹ ਲੇਡੀਜ਼ ਨੂੰ ਇੰਨਾ ਕਮਜ਼ੋਰ ਸਮਝਦਾ ਹੈ ਅੱਜ ਹੁਣ ਚਾਹੇ ਤੁਸੀਂ ਕਿੰਨਾ ਵੀ ਮਰਜ਼ੀ ਕਹਿ ਲਓ ਵੀ ਇੱਕ ਔਰਤਾਂ ਕਿੰਨੀਆਂ ਮਜ਼ਬੂਤ ਨੇ ਆਪਣੇ ਪੈਰਾਂ 'ਤੇ ਖੜ੍ਹੀਆਂ ਨੇ ਫਿਰ ਵੀ ਇੱਕ ਡਰ ਹੈ ਅਤੇ ਤੁਸੀਂ ਬਾਹਰ ਨਹੀਂ ਜਾ ਸਕਦੇ ਰਾਤ ਨੂੰ ਮੁੰਡਿਆਂ ਦੇ ਬਰਾਬਰ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਡਰ ਹੈ ਇਹ ਸੱਚਾਈ ਹੈ ਸਾਡੇ ਇਹਦੀ ਸਮਾਜ ਦੀ ਅਤੇ ਮੈਂ ਆਪ ਤਾਂ ਕਿਸੇ ਰੀਡਿੰਗ ਕਲੱਬ ਦੇ ਵਿੱਚ ਸ਼ਾਮਿਲ ਨਹੀਂ ਹਾਂ ਪਰ ਮੇਰੇ ਨਾਲ ਦੇ ਕਈ ਲੋਕ ਇਹੋ ਜਿਹੇ ਕਲੱਬਾਂ ਵਿੱਚ ਸ਼ਾਮਿਲ ਨੇ ਅਤੇ ਮੈਂ ਇਹਦੇ ਬਾਰੇ ਬਹੁਤ ਸੁਣਿਆ